ਹਾਂਜੀ ਮੈਨੂੰ ਭੋਜਨ ਬਣਾਉਣ ਸਮੇਂ ਮੈਨੂੰ ਐਲਰਜੀ ਹੈ ਅਤੇ ਉਹਦੇ ਵਿੱਚ ਮੇਨ ਜਿਹੜੀ ਮੇਰੇ 'ਤੇ ਐਲਰਜੀ ਜਿਹੜੀ ਮੇਰੇ 'ਤੇ ਬਹੁਤ ਜ਼ਿਆਦਾ ਇਫੈਕਟ ਪ੍ਰਭਾਵ ਪਾਉਂਦੀ ਹੈ ਜਾਂ ਜੋ ਮੇਰੇ 'ਤੇ ਬਹੁਤ ਹੀ ਇਫੈਕਟਿਡ ਹੈ ਉਹ ਹੈ ਕਿ ਜਿਵੇਂ ਜਦੋਂ ਮੈਂ ਲਸਣ ਛਿੱਲਦੀ ਹਾਂ ਅਤੇ ਲਸਣ ਛਿੱਲਣ ਦੇ ਨਾਲ ਮੇਰੇ ਹੱਥਾਂ 'ਤੇ ਖਾਰਸ਼ ਹੋਣ ਲੱਗ ਜਾਂਦੀ ਹੈ ਛਾਲਿਆਂ ਵਾਂਗੂ ਬਣ ਜਾਂਦੇ ਹਨ ਅਤੇ ਇਸ ਤਰ੍ਹਾਂ ਹੀ ਜਦੋਂ ਤੜਕਾ ਲਗਾਉਂਦੀ ਹੈ ਤਾਂ ਉਸ ਵੇਲੇ ਵੀ ਮੂੰਹ ਬੰਨ੍ਹ ਕੇ ਕਿਚਨ ਰਸੋਈ ਦੇ ਵਿੱਚ ਜਾਣਾ ਪੈਂਦਾ ਆ ਕਿਉਂਕਿ ਤੜਕੇ ਤੜਕਾ ਲਾਉਣ ਸਮੇਂ ਮਿਰਚਾਂ ਚੜ੍ਹਦੀਆਂ ਨੇ ਅਤੇ ਜਿਹਦੇ ਕਰਕੇ ਕਈ ਵਾਰੀ ਪਿਆਜ਼ ਵੀ ਜਿਹੜਾ ਹੈ ਉਹ ਪ ਪਿਆਜ਼ ਵੀ ਚੜ੍ਹਦਾ ਹੈ ਅੱਖਾਂ 'ਚੋਂ ਪਾਣੀ ਆਉਣ ਜਾਣ ਲੱਗ ਜਾਂਦਾ ਹੈ ਇਸ ਕਰਕੇ ਉਹ ਵੀ ਬਹੁਤ ਜ਼ਿਆਦਾ ਐਲਰਜੀ ਕਰਦਾ ਹੈ ਔਰ ਇਹਦੇ ਨਾਲ ਨਾਲ ਅਰਬੀ ਛਿੱਲਣ ਵੇਲੇ ਵੀ ਬੜੀ ਮੁਸ਼ਕਲ ਆਉਂਦੀ ਹੈ ਜਿਹਦੇ ਵਾਸਤੇ ਸਭ ਤੋਂ ਪਹਿਲਾਂ ਇਹਨੂੰ ਇਹਦੇ ਨਾਲ ਹੀ ਮੈਨੂੰ ਉਹਨੂੰ ਤੇਲ ਲਗਾਉਣਾ ਪੈਂਦਾ ਹੈ ਤਾਂ ਕਿ ਜਿਹੜੀ ਅਰਬੀ ਹੈ ਮੈਂ ਉਹ ਵਧੀਆ ਚੰਗੀ ਤਰ੍ਹਾਂ ਛਿੱਲ ਸਕਾਂ ਕਿਉਂਕਿ ਇਹ ਕੰਮ ਕਰਨੇ ਪੈਂਦੇ ਹਨ ਪਰ ਇਹ ਨਾਲ ਨਾਲ ਐਲਰਜੀ ਦਾ ਜਿਹੜਾ ਆਪਣੇ ਸਕਿੰਨ ਤੋਂ ਆਪਣੇ ਹੱਥਾਂ ਤੋਂ ਐਲਰਜੀ ਦਾ ਜਿਹੜਾ ਅਸਰ ਹੈ ਉਹ ਵੀ ਘਟਾਉਣ ਦੇ ਵਾਸਤੇ ਮੈਨੂੰ ਇਹ ਸਾਰੇ ਯਤਨ ਕਰਨੇ ਪੈਂਦੇ ਹੈ